ਹਾਂਜੀ ਬਾਈ ਜੀ ਮੈਂ ਆਪਣਾ ਆਪਣੇ ਖਰਚਿਆਂ ਦੇ ਪ੍ਰਬੰਧਨ ਦੀ ਅਤੇ ਬੱਚਤ ਵਗੈਰਾ ਦੀ ਉਹ ਸਾਰੀ ਸਲਾਹ ਕਰਨੀ ਚਾਹੁੰਦਾ ਬਈ ਮੈਂ ਕਿਵੇਂ ਇਹਨੂੰ ਮੈਨੇਜਮੈਂਟ ਕਰ ਸਕਦਾ ਕਿਉਂਕਿ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਸੈਲਰੀ ਵਾਲੇ ਬੰਦੇ ਦਾ ਇੱਕ ਵਾਰ ਤਨਖਾਹ ਆਉਣੀ ਹੁੰਦੀ ਹੈ ਬਾਕੀ ਉੱਦੋਂ ਬਾਅਦ ਤਾਂ ਜਾਣਾ ਹੀ ਜਾਣਾ ਹੁੰਦਾ ਤਾਂ ਉਸ ਦੇ ਵਿੱਚ ਆਪਾਂ ਵੀ ਆਪਣੇ ਖਰਚੇ ਨੂੰ ਕਿਵੇਂ ਮੈਨੇਜ ਕਰ ਸਕਦੇ ਹਾਂ ਅਤੇ ਕਿੱਥੋਂ ਕਿੱਥੋਂ ਆਪਾਂ ਅਨਸੈਸਰੀ ਖਰਚਾ ਜਿਹੜਾ ਉਹ ਵੀ ਕਟੌਤੀ ਕੀਤੀ ਜਾ ਸਕਦੀ ਹੈ ਉਹਦੇ ਬਾਰੇ ਤੁਸੀਂ ਮੈਨੂੰ ਸਹੀ ਰਾਏ ਦੱਸੋ ਹੁਣ ਜਿਵੇਂ ਮੈਂ ਤੁਹਾਨੂੰ ਗੱਲ ਕਰਾਂ ਵੀ ਹਾਊਸ ਰੈਂਟ ਵਗੈਰਾ ਇਹ ਤਾਂ ਚੱਲੋ ਜਾਣਾ ਹੀ ਜਾਣਾ ਇਹ ਤਾਂ ਕਟੌਤੀ ਕਰ ਨਹੀਂ ਸਕਦੇ ਹੁਣ ਬਿਜਲੀ ਦੇ ਬਿਲ ਨੇ ਜਿਵੇਂ ਹੁਣ ਬਿਜਲੀ ਦੇ ਬਿੱਲ ਆਪਾਂ ਨੂੰ ਸਾਲ ਦੇ ਵਿੱਚ ਛੇ ਆਉਂਦੇ ਨੇ ਉਹ ਵੀ ਦੋ ਮਹੀਨਿਆਂ ਦਾ ਬਿੱਲ ਇੱਕ ਵਾਰ ਹੀ 'ਚ ਆਉਂਦਾ ਹੈ ਅਤੇ ਇਸ ਹਿਸਾਬ ਨਾਲ ਛੇ ਬਿਲ ਬਣਦੇ ਹਨ ਜਿਵੇਂ ਸਰਦੀਆਂ ਦੇ ਵਿੱਚ ਤਾਂ ਬਿੱਲ ਆਪਣਾ ਥੋੜ੍ਹਾ ਜਿਹਾ ਘੱਟ ਹੁੰਦਾ ਮੰਨ ਕੇ ਚੱਲੋ ਛੇ ਕੁ ਹਜ਼ਾਰ ਰੁਪਏ ਦੇ ਕਰੀਬ ਹੁੰਦਾ ਔਰ ਗਰਮੀਆਂ ਦੇ ਵਿੱਚ ਇਹ ਬਿੱਲ ਜਿਹੜੀ ਰਕਮ ਇਹ ਅੱਠ ਤੋਂ ਦੱਸ ਹਜ਼ਾਰ ਰੁਪਈਏ ਬਣ ਜਾਂਦੀ ਅਤੇ ਤਕਰੀਬਨ ਤਕਰੀਬਨ ਸਿਆਲਾਂ ਦੇ ਵਿੱਚ ਇਹ ਹੀ ਔਸਤਨ ਰਹਿੰਦੀ ਹੈ ਚਾਰ ਹਜ਼ਾਰ ਪੰਤਾਲੀ ਸੌ ਛੇ ਹਜ਼ਾਰ ਦੇ ਵਿੱਚ ਅਤੇ ਗਰਮੀਆਂ ਦੇ ਵਿਚ ਇਹ ਅੱਠ ਤੋਂ ਲੈ ਕੇ ਦਸ ਹਜ਼ਾਰ ਰੁਪਏ ਤੱਕਰ ਬਣ ਜਾਂਦੀ ਹੈ ਤਾਂ ਇੱਥੇ ਹੁਣ ਮੈਨੂੰ ਤੁਸੀਂ ਇਹ ਸਮਝਾਓ ਵੀ ਆਪਾਂ ਕਿਵੇਂ ਕਿਸੇ ਖ ਖਰਚੇ ਨੂੰ ਘੱਟ ਕਰ ਸਕਦੇ ਹਾਂ ਅਤੇ ਕਿੱਥੋਂ ਆਪਾਂ ਆਪਣੀ ਬੱਚਤ ਨੂੰ ਵਧਾ ਸਕਦੇ ਹਾਂ ਇਸ ਬਾਰੇ ਮੈਂ ਤੁਹਾਡੇ ਨਾਲ ਸਾਰੇ ਖੁੱਲ ਕੇ ਵਿਚਾਰ ਚਰਚਾ ਕਰਨ ਲਈ ਅੱਜ ਤੁਹਾਡੇ ਕੋਲ ਮੁਲਾਕਾਤ ਕੀਤੀ ਹੈ ਤਾਂ ਕਿ ਆਪਾਂ ਖਰਚਾ ਪ੍ਰਬੰਧਨ ਪੂਰੀ ਵਧੀਆ ਤਰੀਕੇ ਨਾਲ ਕਰਕੇ ਬੱਚਤ ਨੂੰ ਵਧਾਇਆ ਜਾ ਸਕੇ ਅਤੇ ਬੇਲੋੜੇ ਖਰਚੇ ਨੂੰ ਘਟਾਇਆ ਜਾ ਸਕੇ